ਬਚਪਨ 'ਚ ਕਰੀ ਯਾਤਰਾ ਵਿੱਚ ਪਹਿਲਾਂ ਅਸੀਂ ਉਰੇ ਤੋਂ ਖਰੜ ਤੋਂ ਕੀਰਤਪੁਰ ਸਾਹਿਬ ਗਏ ਅਤੇ ਉੱਥੇ ਬਾਬਾ ਗੁਰਦਿੱਤਾ ਜੀ ਦੇ ਅਤੇ ਬਾਬਾ ਪੀਰ ਬਾਬਾ ਬੁੱਢਣ ਸ਼ਾਹ ਜੀ ਦੇ ਦੇ ਦਰਸ਼ਨ ਕੀਤੇ ਉਸ ਤੋਂ ਬਾਅਦ ਅਸੀਂ ਅਨੰਦਪੁਰ ਸਾਹਿਬ ਚਲੇ ਗਏ ਅਤੇ ਆਨੰਦਪੁਰ ਸਾਹਿਬ ਜਾ ਕੇ ਅਸੀਂ ਗੁਰਦੁਆਰੇ ਦੇ ਵਿੱਚ ਮੱਥਾ ਟੇਕਿਆ ਅਤੇ ਮੱਥਾ ਟੇਕ ਕੇ ਉੱਥੇ ਕੁਝ ਚਿਰ ਆਰਾਮ ਕਰਨ ਤੋਂ ਬਾਅਦ ਅਸੀਂ ਨੈਣਾ ਦੇਵੀ ਨੂੰ ਚੱਲ ਪਏ ਅਤੇ ਰਸਤੇ ਵਿੱਚ ਕੌਲਾਂ ਵਾਲ਼ੇ ਟੋਬੇ ਪਹੁੰਚੇ ਕੌਲਾਂ ਵਾਲ਼ੇ ਟੋਬੇ ਪਹੁੰਚ ਕੇ ਅਸੀਂ ਮੱਥਾ ਟੇਕਿਆ ਅਤੇ ਉੱਥੇ ਦੇ ਅਸੀਂ ਅਪਣਾ ਸਫ਼ਰ ਸ਼ੁਰੂ ਕਰ ਦਿੱਤਾ ਹੈ ਨੈਣਾ ਦੇਵੀ ਦਾ ਅਤੇ ਅਸੀਂ ਨੈਣਾ ਦੇਵੀ ਜਾ ਕੇ ਮਾਤਾ ਦੇ ਮੱਥਾ ਟੇਕਿਆ ਮੱਥਾ ਟੇਕ ਕੇ ਉੱਥੇ ਆਰਾਮ ਕਰਿਆ ਆਰਾਮ ਕਰਕੇ ਲੰਗਰ ਖਾਇਆ ਲੰਗਰ ਖਾ ਕੇ ਅਸੀਂ ਵਾਪਸ ਘਰ ਆ ਗਏ